ਹੈਲੋ ਵਧੀਆ ਤੂੰ ਦੱਸ ਵਧੀਆ ਵਧੀਆ ਹਾਂ ਅਜੇ ਪਹੁੰਚਣਾ ਤੂੰ ਪੁਹੰਚ ਗਈ ਸੀ ਬਸ ਰਾਹ ਦੇ ਵਿੱਚ ਹਾਂ ਅੱਛਾ ਅੱਛਾ ਅੱਛਾ ਫਿਰ ਤੂੰ ਕਿਵੇਂ ਜਾਂਦੀ ਆ ਅੱਛਾ ਅੱਛਾ

ਹਾਂ ਹਾਂ ਠੀਕ ਹੈ ਠੀਕ ਹੈ ਅੱਛਾ ਅੱਛਾ ਹਾਂ ਹਾਂ ਹਾਂ ਹਾਂ ਅੱਛਾ ਅੱਛਾ ਹਾਂ ਇਹ ਤਾਂ ਗੱਲ ਹੈਗੀ ਆ ਮੈਂ ਵੀ ਹੁਣ ਤਾਂ ਮੈਨੂੰ ਹੋ ਗਿਆ ਮਤਲਬ ਦੋ ਤਿੰਨ ਮਹੀਨੇ ਮੈਂ ਤਾਂ ਬੱਸ ਰਾਹੀਂ ਆਉਂਦੀ ਹਾਂ ਮੈ ਵਧੀਆ ਆਰਾਮ ਨਾਲ ਆਪਣਾ ਘਰ ਪਹੁੰਚਦੀ ਹਾਂ ਬਸ ਹੁਣ ਬਸ ਪਹੁੰਚਣੇ ਵਾਲੀ ਓ ਹਾਂ ਬੱਸ 'ਚ ਬੈਠੀ ਸੀ ਅਤੇ ਐਂ ਆ ਵੀ ਸਿੱਧਾ ਆਪਣਾ ਬੈਠੋ ਆਰਾਮ ਨਾਲ ਆਪਣਾ ਪਹੁੰਚ ਜਾਉ ਕੋਈ ਉਹ ਨਹੀਂ ਹੈਗਾ ਦੋ ਪਿੰਡ ਛੱਡ ਕੇ ਤਾਂ ਪਿੰਡ ਹੈ ਐਨੀ ਦਿੱਕਤ ਵੀ ਨਹੀਂ ਆਉਂਦੀ ਹੈਗੀ ਨਾ ਨਹੀਂ ਹਾਂ ਟਰੇਨ ਵੀ ਹੈਗੀ ਬੱਸਾਂ ਵੀ ਬਟ ਐਂ ਆਂ ਨਾ ਪਿੰਡਾਂ ਵੱਲ ਨੂੰ ਬੱਸਾਂ ਵਾਧੂ ਲੱਗੀਆਂ ਤਾਂ ਫਿਰ ਆਪਣਾ ਆਰਾਮ ਨਾਲ ਸਿੱਧੀ ਫਤਿਹਗੜ੍ਹ ਤੋਂ ਪਿੰਡ ਵਾਲੀ ਬੱਸ ਬੈਠ ਜਾਂਦੇ ਹਾਂ ਦਸ ਮਿੰਟ 'ਚ ਪਿੰਡ ਪਹੁੰਚ ਜਾਂਦੇ ਐਨਾ ਕਿਹ ਦਿੱਕਤ ਹੁੰਦੀ ਆ ਹਾਂ ਹਾਂ ਹੋਰ ਵਧੀਆ ਇਹ ਵੀ ਆ ਹਾਂ ਹਾਂ ਇਹ ਵੀ ਆ ਹਾਂ ਹਾਂ ਮੈਂ ਪਹਿਲਾਂ ਪਹਿਲਾਂ ਸੀ ਮਤਲਬ ਹੁਣ ਸਿਆਲ ਕਰਕੇ ਮੈਂ ਬੱਸ ਆ ਜਾਂਦੀ ਹਾਂ ਨਹੀਂ ਤਾਂ ਅੱਗੇ ਜਿਵੇਂ ਗਰਮੀ ਹੁੰਦੀ ਫਿਰ ਤਾਂ ਮੈਂ ਟਰੇਨ ਦੇ ਵਿੱਚ ਜਾਂਦੀ ਹਾਂ ਟ੍ਰੇਨ ਦੀ ਵੀ ਬਹੁਤ ਵਧੀਆ ਓ ਆ ਮਤਲਬ ਇਹ ਨਹੀਂ ਹੈਗੇ ਬੰਦੇ ਨੂੰ ਖੜ੍ਹਨਾ ਪੈਂਦਾ ਦੋ ਹੈ ਨਾ ਨੇੜਿਉਂ ਆ ਮਤਲਬ ਪਿੰਡ ਦੇ ਨੇੜਿਉਂ ਸਾਡੇ ਸਟੇਸ਼ਨ ਆ ਸਿੱਧੇ ਉੱਥੋਂ ਬੈਠਦੇ ਹਾਂ ਅਤੇ ਫਿਰ ਉੱਥੇ ਉੱਤਰ ਜਾਂਦੇ ਹਾਂ

ਹਾਂ ਹਾਂ ਕੋਈ ਨਾ ਓਕੇ